ਪੰਜਾਬ ਵਿੱਚ ਲੋਕ ਆਪਣਾ ਵਿਹਲਾ ਸਮਾਂ ਵਿਹਲਾ ਸਮੇਂ ਵਿੱਚ ਜਿਵੇਂ ਕਿ ਯੋਗਾ ਹੈ ਯੋਗਾ ਨੂੰ ਉਹ ਵਧੀਆ ਤਰੀਕੇ ਨਾਲ ਕਰਦੇ ਹਨ ਹੋਰ ਵੀ ਜਿਵੇਂ ਉਹ ਪੰਜਾਬੀ ਜਿਵੇਂ ਬਹੁਤ ਵਿਹਲੇ ਹੁੰਦੇ ਹਨ ਉਹਨਾਂ ਨੂੰ ਖੇਡਣਾ ਕੁੱਦਣਾ ਬੜਾ ਪਸੰਦ ਹੁੰਦਾ ਹੈ ਉਹ ਖੇਡਣ ਲਈ ਕਈ ਕ੍ਰਿਕਟ ਵਗੈਰਾ ਖੇਡਣ ਚੱਲ ਜਾਂਦੇ ਹਨ ਕਈ ਵਾਰ ਉਹ ਉਹਨਾਂ ਨੂੰ ਖਾਣਾ ਵੀ ਬਹੁਤ ਪਸੰਦ ਹੁੰਦਾ ਹੈ ਇਸ ਕਰਕੇ ਉਹ ਵੱਖ ਵੱਖ ਥਾਵਾਂ 'ਤੇ ਜਾ ਕੇ ਉਹ ਖਾਣਾ ਪੀਣਾ ਵੀ ਬਹੁਤ ਪਸੰਦ ਕਰਦੇ ਹਨ ਕਈ ਵਾਰ ਅਤੇ ਕਈ ਵਾਰ ਜਿਵੇਂ ਕਿ ਸਾਨੂੰ ਉਹ ਦੋ ਵਗੈਰਾ ਛੁੱਟੀਆਂ ਦੋ ਛੁੱਟੀਆਂ ਲਗਾ ਲਓ ਅਤੇ ਉਹ ਦੋ ਛੁੱਟੀਆਂ ਵਿੱਚ ਡਲਹੋਜ਼ੀ ਵਗੈਰਾ ਮਨਾਲੀ ਵਗੈਰਾ ਲਈ ਟੂਰ ਵਗੈਰਾ ਘੁੰਮਣ ਲਈ ਚਲ ਜਾਂਦੇ ਹਨ ਉੱਥੇ ਜਾ ਕੇ ਉਹ ਵੱਖ ਵੱਖ ਥਾਵਾਂ 'ਤੇ ਟ੍ਰੈਵਲਿੰਗ ਵੀ ਕਰਦੇ ਵੱਖ ਵੱਖ ਥਾਵਾਂ 'ਤੇ ਟ੍ਰੈਵਲਿੰਗ ਕਰਦੇ ਹਨ ਅਤੇ ਹੋਰ ਵੀ ਹੋਰ ਵੀ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਹਨ ਜਿੱਥੇ ਜਿਵੇਂ ਕਿ ਉਹ ਉਹ ਚੀ ਜਿਵੇਂ ਕਿ ਉਹ ਟ੍ਰੈਵਲਿੰਗ ਵਗੈਰਾ ਕਰਦੇ ਹਨ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹਨ ਜਿਵੇਂ ਕਿ ਉੱਥੇ ਕਰਨ ਲਈ ਹੋਰ ਖਾਣ ਪੀਣ ਵਗੈਰਾ ਉੱਥੇ ਕਰਦੇ ਹਨ ਹੋਰ ਖਾਣ ਪੀਣ ਵਗੈਰਾ ਘੁੰਮਦੇ ਹਨ ਜਿਵੇਂ ਕਿ ਉੱਥੇ ਆਪਾਂ ਕਾਰ ਲੈ ਕੇ ਗਏ ਅਤੇ ਉੱਥੇ ਸਾਨੂੰ ਬੜਾ ਮਜ਼ਾ ਆਇਆ ਅਤੇ ਆਪਾਂ ਉੱਥੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਜਿਵੇਂ ਟਰੈਵਲਿੰਗ ਖਾਣ ਪੀਣ ਵਗੈਰਾ ਉੱਥੇ ਰੂਮ ਆਪਾਂ ਰੈਂਟ 'ਤੇ ਲਿੱਤਾ ਰੂਮ ਆਪਾਂ ਰੈਂਟ 'ਤੇ ਲਿੱਤਾ ਅਤੇ ਹੋਰ ਉੱਥੇ ਆਪਾਂ ਟ੍ਰੈਵਲਿੰਗ ਕੀਤੀ ਘੁੰਮੇ ਫਿਰੇ ਵਗੈਰਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਜਿਵੇਂ ਕਿ ਹੋਰਸ ਰਾਈਡਿੰਗ ਗੋਲਫ ਰਾਈਡਿੰਗ ਹੋਰ ਵੀ ਆਪਾਂ ਉੱਥੇ ਜਾ ਕੇ ਸ਼ਿਲਾਂਗ ਵੈਲੀ ਵਗੈਰਾ ਗਏ ਉੱਥੇ ਵੀ ਆਪਾਂ ਬਹੁਤ ਘੁੰਮੇ ਸ਼ੌਂਕ ਨਾਲ ਅਤੇ ਇਸ ਤਰ੍ਹਾਂ ਆਪਾਂ ਹੋਰ ਵੀ ਜਿਵੇਂ ਯੋਗਾ ਕੀਤੀ ਸਪੋਰਟਸਮੈਨਸ਼ਿਪ ਉੱਥੇ ਕੀਤੀ ਕ੍ਰਿਕਟ ਵਗੈਰਾ ਖੇਡੇ ਕ੍ਰਿਕਟ ਵਗੈਰਾ ਖੇਡੇ ਹੋਰ ਵੀ ਉੱਥੇ ਬੈਡਮਿੰਨਟ ਟੈਨਿਸ ਵਗੈਰਾ ਖੇਡੇ ਅਤੇ ਇਸ ਤਰ੍ਹਾਂ ਉਹ ਪੰਜਾਬੀ ਆਪਣਾ ਸਮਾਂ ਬਤੀਤ ਕਰਦੇ ਹਨ